ਜਿਵੇਂ ਅਸੀਂ ਸਵੇਰੇ ਪਰਮਾਤਮਾ ਨੂੰ ਯਾਦ ਕਰਦੇ ਹਾਂ ਉਸ ਤਰ੍ਹਾਂ ਹੀ ਪ੍ਰਾਣਾਯਾਮ ਕਰਕੇ ਅਸੀਂ ਯੋਗਾ ਨੂੰ ਯਾਦ ਕਰਦੇ ਹਾਂ ਯੋਗਾ ਨਾ ਯੋਗਾ ਸਾਡੇ ਜੀਵਨ ਵਿੱਚ ਇੱਕ ਅਲੱਗ ਤਰ੍ਹਾਂ ਸ਼ਾਮਿਲ ਹੁੰਦਾ ਹੈ ਕਿਉਂ ਕਰਕੇ ਯੋਗਾ ਨਾਲ ਸਾਡੀ ਅਟੈਚਮੈਂਟ ਹੁੰਦੀ ਇਸ ਲਈ ਹੁੰਦੀ ਹੈ ਕਿ ਅਸੀਂ ਆਪਣੇ ਸਰੀਰ ਵਿੱਚ ਕੁਝ ਯੋਗ ਕਰਕੇ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਂਦੇ ਹਾਂ ਅਤੇ ਯੋਗਾ ਨਾਲ ਸਾਨੂੰ ਕਈ ਤਰ੍ਹਾਂ ਦੇ ਲਾਭ ਮਿਲਦੇ ਹਨ ਯੋਗਾ ਕਰਨ ਨਾਲ ਸਾਡੇ ਜੀਵਨ ਵਿੱਚ ਇੱਕ ਨਵੀਂ ਰੋਸ਼ਨੀ ਆਉਂਦੀ ਹੈ ਤੰਦਰੁਸਤੀ ਆਉਂਦੀ ਹੈ ਜਿਸ ਨਾਲ ਕਿ ਸਾਡਾ ਚਿਹਰਾ ਚਿਹਰਾ ਈਵਨ ਕਿ ਸਾਡਾ ਜਿਹੜਾ ਪੂਰਾ ਸਰੀਰ ਹੈ ਇੱਕ ਤਰੋ ਤਾਜ਼ਾ ਮਹਿਸੂਸ ਕਰਦਾ ਹੈ ਯੋਗਾ ਇਨਸਾ ਯੋਗਾ ਨਾਲ ਅਟੈਚਮੈਂਟ ਕਰਨ ਨਾਲ ਇਨਸਾਨ ਨੂੰ ਆਪਣਾ ਜੀਵਨ ਇੱਕ ਇੰਝ ਲੱਗਦਾ ਹੈ ਜਿਵੇਂ ਅਸੀਂ ਯੋਗਾ ਕਰਨ ਨਾਲ ਬੜਾ ਆਪਣੇ ਆਪ ਨੂੰ ਹਲਕਾ ਮਹਿਸੂਸ ਕਰ ਰਹੇ ਹਾਂ ਆਪਣੇ ਸਾਡੀ ਜਿਹੜੀ ਦਿਨ ਚਾਰਿਆ ਜਦੋਂ ਅਸੀਂ ਯੋਗਾ ਨਾਲ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਇੰਝ ਮਹਿਸੂਸ ਹੁੰਦਾ ਵੀ ਸਾਡਾ ਦਿਨ ਸਾਰਾ ਬੜਾ ਹੀ ਵਧੀਆ ਤਰੀਕੇ ਵਿੱਚ ਗੁਜਰਿਆ ਮਾਨਸਿਕ ਸ਼ਾਂਤੀ ਮਿਲਦੀ ਹੈ ਅਸੀਂ ਮੈਂਟਲੀ ਬਿਲਕੁਲ ਜਿਹੜਾ ਸਾਨੂੰ ਇੱਕ ਸੁੱਖ ਅਨੁਭਵ ਹੁੰਦਾ ਹੈ ਯੋਗਾ ਕਰਨ ਨਾਲ ਯੋਗਾ